ਸਪੀਕ ਆਊਟ ਦਾ ਫੋਲੋਇੰਗ ਨੇਮ ਆਫ ਵਹੀਕਲ ਐਂਡ ਲੈਕਸਸ ਯੂ ਐਕਸ ਐਮ ਜੀ ਫੋਰ ਏ ਵੀ ਸਜ਼ੂਕੀ ਏ ਪੀ ਬੀ